ਮੈਂ ਇੱਕ ਵਿਦੇਸ਼ੀ ਯਾਤਰਾ ਕਰਨ ਬਾਰੇ ਸੋਚ ਰਹੀ ਹਾਂ ਮੈਂ ਸੋਚ ਰਹੀ ਹਾਂ ਕਿ ਮੈਂ ਅਮਰੀਕਾ ਜਾਵਾਂ ਆਪਦੇ ਇੱਕ ਦੋਸਤ ਦੇ ਨਾਲ ਅਮਰੀਕਾ ਜਾਣ ਪਿੱਛੇ ਮੇਰਾ ਕਾਰਨ ਇਹ ਹੈ ਕਿ ਮੈਂ ਅਮਰੀਕਾ ਨੂੰ ਦੇਖਾਂ ਸਮਝਾਂ ਉੱਥੋਂ ਦਾ ਪਹਿਰਾਵਾ ਕੀ ਆ ਉੱਥੋਂ ਦੀ ਬੋਲੀ ਕੀ ਆ ਉੱਥੋਂ ਦਾ ਸੱਭਿਆਚਾਰ ਕੀ ਆ ਤਾਂ ਮੈਂ ਸੋਚ ਰਹੀ ਹਾਂ ਕਿ ਮੇਰਾ ਜਿਹੜਾ ਮੋਬਾਈਲ ਫੋਨ ਆ ਉਹ ਅੰਤਰਰਾਸ਼ਟਰੀ ਰੋਮਿੰਗ ਦੇ ਵਿੱਚ ਹੋਵੇ ਤਾਂ ਕਿ ਮੈੈਂ ਉਹਨਾਂ ਦੀਆਂ ਸਾਰੀਆਂ ਸੁਵਿਧਾਵਾਂ ਦਾ ਆਨੰਦ ਮਾਣ ਸਕਾਂ ਅਮਰੀਕਾ ਦੇ ਵਿੱਚ ਮੈਂ ਸੋਚ ਰਹੀ ਆ ਵੈਸੇ ਹੈਗਾ ਤਾਂ ਬਹੁਤ ਕੁਛ ਆ ਦੇਖਣ ਵਾਸਤੇ ਪਰ ਸੈਨ ਫਰਾਂਸਿਸਕੋ ਨਿਊਯੋਰਕ ਲੋਸਐਂਜਲਸ ਸ਼ਿਕਾਗੋ ਵਾਸ਼ਿੰਗਟਨ ਡੀਸੀ ਅਤੇ ਲੋਸਵਿੰਗਸ ਪਰ ਮੈਂ ਸੋਚਿਆ ਵਾ ਕਿ ਨਿਊਯੋਰਕ ਦੇ ਵਿੱਚ ਜਾਵਾਂ ਉਹਨੂੰ ਦੇਖਾਂ ਸੁਣਾ ਸਮਝਾਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਨਿਊਯੋਰਕ ਬਾਰੇ ਦੱਸਿਆ ਗਿਆ ਹੈ ਨਿਊਯੋਰਕ ਦੇ ਵਿੱਚ ਦੇਖਣ ਵਾਲਾ ਬਹੁਤ ਕੁਛ ਹੈ ਜਿਵੇਂ ਸਟੈਚੂ ਓਫ ਲਿਬਰਟੀ ਦ ਮੈਟਰੋਪੋਲੀਟਨ ਮਿਊਜ਼ੀਅਮ ਓਫ ਆਰਟ ਐਂਡ ਸੈਂਟਰਲ ਪਾਰਕ ਇੰਪਾਇਰ ਸਟੇਟ ਬਿਲਡਿੰਗ ਵੀ ਹੈਗੀ ਆ ਉੱਥੇ ਬਰੋਕਲੀਨ ਬ੍ਰਿਜ ਵੀ ਆ ਟਾਈਮ ਸਕੇਅਰ ਵੀ ਆ ਅਤੇ ਨੌ ਗਿਆਰਾਂ ਮੈਮੋਰੀਅਲ ਮਿਊਜ਼ੀਅਮ ਵੀ ਹੈਗਾ ਉੱਥੇ ਅਮੈਰੀਕਨ ਮਿਊਜ਼ੀਅਮ ਓਫ ਨੈਚੁਰਲ ਹਿਸਟਰੀ ਜਿਹੜੀ ਹਿਸਟਰੀ ਹੈ ਸਾਡੀ ਜਾਨਵਰਾਂ ਦੀ ਉਹਦੇ ਬਾਰੇ ਉੱਥੇ ਰ ਉੱਥੇ ਦੱਸਿਆ ਗਿਆ ਉੱਥੇ ਡਾਇਨਾਸੌਰ ਨੂੰ ਵੀ ਰੱਖਿਆ ਗਿਆ ਹੈ ਉਹਦਾ ਡਾਇਨਾਸੌਰ ਦਾ ਉੱਥੇ ਪਿੰਜਰ ਵੀ ਹੈਗਾ ਟੋਪ ਓਫ ਦਾ ਰੋਕ ਇੱਕ ਬਿਲਡਿੰਗ ਆ ਉਹਨੂੰ ਦੇਖਾਂ ਰੋਕਫਿਲਰ ਸੈਂਟਰ ਉਹ ਦ ਮਿਊਜ਼ੀਅਮ ਓਫ ਮੋਡਰਨ ਆਰਟ ਅੱਜ ਕੱਲ੍ਹ ਦਾ ਜਿਹੜਾ ਆਰਟ ਆ ਉਹਦੇ ਬਾਰੇ ਇੱਥੇ ਰੱਖਿਆ ਗਿਆ ਹੈ ਅਤੇ ਵਸ਼ਿੰਗਟਨ ਸਕੇਅਰ ਪਾਰਕ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਜਿਹੜੀਆਂ ਉੱਥੇਂ ਦੇਖੀਆਂ ਜਾ ਸਕਦੀਆਂ ਨੇ ਤਾਂ ਮੇਰਾ ਸ ਉੱਥੇ ਰਹਿਣ ਦਾ ਟੈਮ ਆ ਉਹ ਜਿਹੜਾ ਉਹ ਇੱਕ ਮਹੀਨਾ ਹੋਵੇਗਾ ਤਾਂ ਕਿ ਮੈਂ ਇੱਕ ਮਹੀਨੇ ਦੇ ਵਿੱਚ ਇੰਨਾ ਸਾਰਾ ਕੁਛ ਦੇਖ ਸਕਾਂ ਸਮਝ ਸਕਾਂ ਉਹਨਾਂ ਦਾ ਸੱਭਿਆਚਾਰ ਨੂੰ ਉਹਨਾਂ ਦਾ ਖਾਣਾ ਉਹਨਾਂ ਦਾ ਰੋਟੀ ਪਾਣੀ ਉਹਨਾਂ ਦਾ ਤੌਰ ਤਰੀਕਾ ਕਿ ਉੱਥੋਂ ਦਾ ਟਾਈਮ ਭਾਰਤ ਅਤੇ ਅਮਰੀਕਾ ਦੇ ਟੈਮ ਦੇ ਵਿੱਚ ਵੀ ਫਰਕ ਹੋਵੇਗਾ ਸੋ ਸਭ ਤੋਂ ਜ਼ਿਆਦਾ ਮੈਨੂੰ ਇਹ ਆ ਮੇਨ ਜ਼ਰੂਰੀ ਗੱਲ ਇਹ ਹੈ ਕਿ ਮੇਰੀ ਜਿਹੜੀ ਅੰਤਰਾਸ਼ਟਰੀ ਰੋਮਿੰਗ ਆ ਉਹ ਮੈਨੂੰ ਉਪਲਬਧ ਕੀਤੀ ਜਾਵੇ ਤਾਂ ਕਿ ਮੈਂ ਉੱਥੋਂ ਉੱਥੇ ਜਾ ਕੇ ਵੀ ਇਹਦਾ ਆਨੰਦ ਮਾਣ ਸਕਾਂ ਮੈਨੂੰ ਕੋਈ ਉੱਥੇ ਦਿੱਕਤ ਨਾ ਆਵੇ ਮੈਨੂੰ ਹੋਰ ਕੋਈ ਸਿਮ ਨਾ ਲੈਣਾ ਪਵੇ ਮੇਰੀ ਇੰਟਰੈਸ਼ਨਲ ਜਿਹੜੀ ਰੋਮਿੰਗ ਅੰਤਰਰਾਸ਼ਟਰੀ ਰੋਮਿੰਗ ਆ ਜਿਹੜੀ ਮੈਨੂੰ ਉਪਲਬਧ ਕੀਤੀ ਜਾਵੇ ਮੈਨੂੰ ਮੁਹੱਈਆ ਕੀਤੀ ਜਾਵੇ ਅਤੇ ਮੇਰਾ ਉੱਥੇ ਜਾਣ ਦਾ ਬਸ ਮਕਸਦ ਇਹੀ ਆ ਘੁੰਮਣ ਫਿਰਨਾ ਮੈਨੂੰ ਵਧੀਆ ਲੱਗਦਾ ਵਾ ਹੁਣ ਸੋਚਿਆ ਕਿ ਅਮਰੀਕਾ ਜਾ ਕੇ ਆਈਏ ਇੱਥੇ ਦੇਖੀਏ ਕੀ ਕੁਛ ਹੈਗਾ ਕੀ ਕੁਛ ਨਹੀਂ ਹੈਗਾ ਕਿਉਂਕਿ ਦੁਨੀਆਂ 'ਚ ਦੁਨੀਆਂ 'ਚ ਸੁਣਿਆ ਹੋਇਆ ਕਿ ਅਮਰੀਕਾ ਬਹੁਤ ਵਧੀਆ ਦੇਸ਼ ਆ ਉੱਥੇ ਬਹੁਤ ਕੁਛ ਦੇਖਣ ਵਾਲਾ ਵੀ ਹੈਗਾ ਵਾ ਅਤੇ ਅਗਰ ਵਧੀਆ ਲੱਗਾ ਤਾਂ ਹੋ ਸਕਦਾ ਕਿ ਮੈਂ ਇੱਕ ਦੋ ਦਿਨ ਜਾਂ ਹਫਤਾ ਹੋਰ ਠਹਿਰ ਸਕਾ ਉੱਥੇ ਅਤੇ ਮੈਂ ਇਹ ਸਾਰਾ ਕੁਛ ਜੋ ਤੁਹਾਨੂੰ ਦੱਸਿਆ ਇਹ ਸਾਰਾ ਕੁਛ ਦੇਖ ਕੇ ਆਊਗੀ ਦੇਖੂਗੀ ਫੋਟੋਆਂ ਖਿੱਚੂਗੀ ਉੱਥੋਂ ਦੀਆਂ ਯਾਦਾਂ ਨਾਲ ਲੈ ਕੇ ਆਊਗੀ ਉੱਥੋਂ ਦਾ ਖਾਣਾ ਸਾਰਾ ਦੇਖ ਕੇ ਸਾਰਾ ਪਸੰਦ ਕਰਕੇ ਆਊਗੀ ਬਾਕੀ ਮੈਨੂੰ ਅੰਤਰਰਾਸ਼ਟਰੀ ਰੋਮਿੰਗ ਮੁਹੱਈਆ ਕੀਤੀ ਜਾਵੇ